ਭੰਗੜਾ ਇੱਕ ਪੰਜਾਬ ਅਤੇ ਸਿੱਖਾਂ ਦਾ ਬਹੁਤ ਹੀ ਮਹੱਤਵਪੂਰਨ ਨਾਚ ਹੈ ਅਤੇ ਇਸ ਨੂੰ ਪੰਜਾਬੀ ਅਤੇ ਸਿੱਖ ਬਹੁਤ ਹੀ ਖੁਸ਼ ਹੋ ਕੇ ਨੱਚਦੇ ਹਨ ਜਾਂ ਭੰਗੜਾ ਕਰਦੇ ਹਨ ਇਹ ਭੰਗੜੇ ਦੀ ਮਹੱਤਤਾ ਇਸ ਪੱਖੋਂ ਵੀ ਹੈ ਕਿ ਇਸ ਨੂੰ ਕਰਨ ਵਾਲਾ ਸਰੀਰਕ ਤੌਰ 'ਤੇ ਤੰਦਰੁਸਤ ਰਹਿੰਦਾ ਅਤੇ ਇਹ ਬਹੁਤ ਹੀ ਵਧੀਆ ਨਾਚ ਹੈ ਇਸ ਨੂੰ ਮਰਦ ਅਤੇ ਔਰਤਾਂ ਦੋਨੋਂ ਹੀ ਕਰ ਸਕਦੇ ਹਨ ਅਤੇ ਭੰਗੜਾ ਪੂਰੀ ਦੁਨੀਆਂ ਵਿੱਚ ਪ੍ਰਚਲਤ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਦੁਨੀਆਂ ਦੇ ਹਰੇਕ ਕੋਨੇ ਵਿੱਚ ਇੱਕ ਨਾ ਇੱਕ ਪੰਜਾਬੀ ਵਸਿਆ ਹੋਇਆ ਹੈ ਅਤੇ ਜੋ ਪੰਜਾਬੀ ਉੱਥੇ ਵਸੇ ਹੋਏ ਹਨ ਉਹ ਭੰਗੜਾ ਕਰਦੇ ਹਨ ਅਤੇ ਆਸ ਪਾਸ ਦੇ ਲੋਕ ਉਸ ਨੂੰ ਵੇਖ ਕੇ ਭੰਗੜਾ ਨੂੰ ਪਸੰਦ ਕਰਨ ਲੱਗ ਜਾਂਦੇ ਹਨ ਇਸ ਲਈ ਕਹਿ ਸਕਦੇ ਹਾਂ ਕਿ ਦੁਨੀਆਂ ਵਿੱਚ ਭੰਗੜਾ ਬਹੁਤ ਪ੍ਰਚਲਿਤ ਹੈ